ਪੁਰਾਣੇ ਸਿੱਕੇ ਇਕੱਠੇ ਕਰਨ ਨਾਲ ਸਾਨੂੰ ਉਨ੍ਹਾਂ ਦੇ ਉੱਪਰ ਲਿਖੇ ਹੋਏ ਸੰਨ ਇਹਨਾਂ ਤੋਂ ਪਤਾ ਲੱਗਦਾ ਹੈ ਵੀ ਇਹ ਕਿਹੜੇ ਸੰਨ ਦੇ ਹੈਗੇ ਹੈ ਅਤੇ ਉਹਦੇ ਨਾਲ ਇਤਿਹਾਸ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ ਜੋ ਅੱਜ ਦੇ ਡੇਟ ਵਿੱਚ ਅਸੀਂ ਸਿੱਖਦੇ ਹੈ ਵੀ ਜਿਹੜੇ ਪਹਿਲਾਂ ਇੱਕ ਰੁਪਈਏ ਦਾ ਸਿੱਕਾ ਆਉਂਦਾ ਹੁੰਦਾ ਸੀਗਾ ਉਹਦੇ ਪਰ ਕਿਸਾਨ ਦੀ ਇੱਕ ਤਸਵੀਰ ਹੁੰਦੀ ਸੀ ਜਿਹਦੇ ਉੱਤੇ ਇੱਕ ਕਣਕ ਦੀ ਬਾਲੀ ਦੀ ਵੀ ਤਸਵੀਰ ਹੁੰਦੀ ਸੀ ਹੱਲ ਚਲਾਉਂਦਾ ਕਿਸਾਨ ਹੁੰਦਾ ਸੀ ਅਤੇ ਉਹਦੇ ਨਾਲ ਪਤਾ ਲੱਗਦਾ ਸੀ ਵੀ ਇਹਦੇ ਵਿੱਚ ਕਿਸਾਨ ਸਾਨੂੰ ਕੀ ਦਿੰਦਾ ਹੈ ਅਤੇ ਅੱਜ ਦੇ ਡੇਟ ਦੇ ਵਿੱਚ ਜਿਹੜਾ ਉਹਦੇ ਪਰ ਠੈਂਗਾਂ ਬਣਿਆ ਵਾ ਹੁੰਦਾ ਹੈ ਅਤੇ ਇਸ ਤੋਂ ਪਤਾ ਲੱਗਦਾ ਵੀ ਅੱਜ ਇੱਕ ਰੁਪਏ ਦੇ ਵਿੱਚ ਕੀ ਮਿਲਦਾ